ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ

ਹਾਂਜੀ ਹਾਂਜੀ ਆ ਜਾਉ ਤੁਸੀਂ ਪੰਜਾਬ ਆ ਜਾਉ ਜੀ ਬੱਚਿਆਂ ਨੂੰ ਨਾਲ ਲੈ ਆਉਣਾ ਕਿ ਤੁਸੀਂ ਕੱਲਿਆਂ ਨੇ ਆਉਣਾ ਹੈ

ਹਾਂਜੀ ਠੀਕ ਆ ਜੀ ਵੈਸੇ ਠੀਕ ਹੈ ਪੰਜਾਬ ਬਹੁਤ ਵਧੀਆ ਇਲਾਕਾ ਠੰਡਾ ਮੌਸਮ ਆ ਇੱਥੇ ਅਤੇ ਵਧੀਆ ਆਪਾਂ ਹੁਣ ਉਰੇ ਬਾਰਵੇਂ ਮਹੀਨੇ ਦੇ ਵਿੱਚ ਅਤੇ ਸ਼ਹੀਦੀ ਸਿੰਘ ਸਭਾ ਸ਼ੁਰੂ ਸ਼ੁਰੂ ਹੋ ਜਾਣੀ ਅਤੇ ਉਸਨੂੰ ਇੱਧਰ ਘੁੰਮਾ ਲਿਆਉਂਗਾ ਸ ਸਭਾ 'ਤੇ ਅਤੇ ਇੱਥੇ ਜੋਤੀ ਸਰੂਪ ਸਾਹਿਬ ਗੁਰਦੁਆਰਾ ਹੈ ਅਤੇ ਉੱਥੇ ਹਾਂਜੀ ਹਾਂਜੀ ਫਤਹਿਗੜ੍ਹ ਸਾਹਿਬ ਆਓ ਜੀ ਤੁਹਾਨੂੰ ਇੱਥੇ ਫਤਹਿਗੜ੍ਹ ਸਾਹਿਬ ਦੇ ਵਿਚ ਤੁਹਾਨੂੰ ਜੋਤੀ ਸੂਪ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਘੁੰਮਾਉਣਾ ਹੈ ਜੇ ਅਤੇ ਉਹ ਤੋਂ ਬਾਅਦ ਆਪਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜੀ ਇੱਥੇ ਨੀਹਾਂ 'ਚ ਚਿਣੇ ਤੇ ਅਤੇ ਉਹ ਉਹ ਦਿਖਾ ਦਿਆਂਗੇ ਅਤੇ ਠੰਡਾ ਬੁਰਜ ਵੀ ਹੈਗਾ ਉਰੇ ਆਪਣੇ ਉੱਥੇ ਵੀ ਦਰਸ਼ਨ ਕਰਾ ਲਿਆਉਂਗੇ ਠੀਕ ਹੈ ਹਾਂਜੀ ਅਤੇ ਹੋਰ ਇੱਥੇ ਸਟੇਸ਼ਨ ਹੈਗਾ ਅਤੇ ਆਪਣਾ ਇੱਥੇ ਅਤੇ ਵਧੀਆ ਵਾਤਾਵਰਨ ਬਹੁਤ ਵਧੀਆ ਇੱਥੇ ਦਾ ਠੀਕ ਆ ਜੀ ਹਾਂਜੀ ਆਪਣੇ ਕੱਪੜੇ ਕੁੱਪੜੇ ਨਾਲ ਲਿਆਇਓ ਹਾਂਜੀ ਮੌਸਮ ਬਹੁਤ ਬਹੁਤ ਵਧੀਆ ਠੀਕ ਠਾ ਹੈ ਠੰਡਾ ਜਿਹਾ ਮੌਸਮ ਆ ਠੀਕ ਹੈ ਕੱਪੜੇ ਕੁੱਪੜੇ ਆਪਣੇ ਨਾਲ ਲਿਆਓ ਹਾਂਜੀ ਹਾਂਜੀ ਅਤੇ ਆਪਾਂ ਇ ਇੱਥੇ ਤੁਹਾਨੂੰ ਘੁੰਮਾਉਣਾ ਹੈ ਕਿਤੇ ਹੋਰ ਇ ਅਤੇ ਇਹ ਰੋਜ਼ਾ ਸ਼ਰੀਫ ਵੀ ਹੈਗਾ ਆਪਣਾ ਇੱਥੇ ਠੀਕ ਆ ਅਤੇ ਰੋਜ਼ਾ ਸ਼ਰੀਫ ਅਤੇ ਉਹ ਆਪਣਾ ਉੱਥੇ ਨਹਿਰ ਨਹਿਰ 'ਤੇ ਇੱਕ ਹੋਸਟਲ ਬਹੁਤ ਹੋਟਲ ਬਹੁਤ ਵਧੀਆ ਬਣਿਆ ਅਤੇ ਇੱਥੇ ਦੇ ਰੈਸਟੋਰੈਂਟ ਵੀ ਬਹੁਤ ਵਧੀਆ ਹੈ ਇੱਥੇ ਦੇ ਆਪਣੇ ਵਾਤਾਵਰਨ ਠੀਕ ਆ ਹਾਂਜੀ ਹਾਂਜੀ ਹਾਂ ਹਾਂਜੀ ਆਮ ਖਾਸ ਬਾਗ਼ ਵੀ ਹੈਗਾ ਜੀ ਉੱਥੇ ਇਹਦੇ ਲਾਗ ਹੈ ਜੀ ਇੱਥੇ ਆਪਣੇ ਚਾਰ ਪੰਜ ਨਾ ਹੋ ਕੇ ਉੱਥੇ ਉੱਥੇ ਬਹੁਤ ਵਧੀਆ ਮਾਹੌਲ ਵਾਤਾਵਰਣ ਵਧੀਆ ਉੱਥੇ ਹਾਂਜੀ ਹਾਂਜੀ ਹਾਂਜੀ ਹਾਂਜੀ ਓਕੇ ਹਾਂਜੀ ਅਤੇ ਤੁਹਾਨੂੰ ਕਿਹਾ ਸਰ ਦੱਸਦਾ ਕਿ ਫਤਿਹਗੜ੍ਹ ਸਾਹਿਬ ਇੱਥੇ ਠੀਕ ਹੈ ਜੀ ਤੁਸੀਂ ਆ ਜਾਇਓ ਫਿਰ ਨਾਲ ਬੱਚਿਆਂ ਨੂੰ ਲੈ ਕੇ ਆਇਓ ਜੀ ਠੀਕ ਹੈ ਜੀ ਹਾਂਜੀ ਆ ਜਾਇਓ ਜੀ ਚੰਗਾ ਜੀ